ਇੱਕ ਸੌ ਬਾਰ੍ਹਾਂ ਪੰਜ ਸੌ ਪੰਜਾਹ ਅੱਠ ਹਜ਼ਾਰ ਸੱਤਰ ਬਾਰ੍ਹਾਂ ਹਜ਼ਾਰ ਸੱਤ ਸੌ ਅੱਸੀ ਇੱਕ ਲੱਖ ਬੱਤੀ ਹਜ਼ਾਰ ਸੱਤ ਸੌ ਸੱਠ